ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਮੈਂ ਨਵਦੀਪ ਕੌਰ ਬੋਲ ਰਹੀ ਹਾਂ ਮੈਂ ਨਾ ਨਵਦੀਪ ਕੌਰ ਵਲੋਗਰ ਹਾਂ ਇੱਕ ਹਾਂਜੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਮੈਂ ਨਾ ਵਲੋਗ ਬਣਾਉਂਦੀ ਹਾਂ ਅਤੇ ਅਤੇ ਮੈਂ ਤੁਹਾਨੂੰ ਇਹ ਕਹਿੰਦੀ ਸੀ ਵੀ ਮਤਲਬ ਕਿ ਜਿਵੇਂ ਅੱਜ ਕੱਲ੍ਹ ਲੋਕ ਬਾਹਰ ਜਾ ਰਹੇ ਆ ਅਤੇ ਮੈਂ ਉਹਨਾਂ 'ਤੇ ਵਲੋਗ ਬਣਾਉਂਦੀ ਹਾਂ ਵੀ ਮੈਂ ਇਹ ਵੀ ਕਹਿ ਸਕਦੀ ਹਾਂ ਵੀ ਲੋਕ ਬਾਹਰ ਜਾਂਦੇ ਆ ਉਹ ਇੱਧਰ ਰਹਿ ਕੇ ਵੀ ਕੁਛ ਨਾ ਕੁਛ ਕਰ ਸਕਦੇ ਹੈ ਕੰਮ ਕਰ ਸਕਦੇ ਹੈ ਜੋ ਕਿ ਬਾਹਰ ਜਾ ਜਾ ਕੇ ਨਾ ਉਹ ਕੰਮ ਕਰਦੇ ਹਾਂ ਬਾ ਜੋ ਉਹਨਾਂ ਨੂੰ ਇੱਧਰ ਜ਼ਿਆਦਾ ਕਮਾਈ ਮਿਲ ਸਕਦੀ ਹੈ ਕੰਮ ਕਰਕੇ ਮੈਂ ਇਹਨਾਂ ਚੀਜ਼ਾਂ 'ਤੇ ਵਲੋਗ ਬਣਾਉਂਦੀ ਹਾਂ ਹਾਂਜੀ ਇਹ ਤਾਂ ਹੈ ਬਟ ਵੈਸੇ ਇੱਧਰ ਜ਼ਿਆਦਾ ਮਤਲਬ ਕਿ ਕਮਾਈ ਇੱਧਰ ਆ ਰਹਿ ਕੇ ਵੀ ਕਮਾਈ ਕਰ ਸਕਦੇ ਆ ਬਾਹਰ ਫੋਰਨ ਦੇ ਵਿੱਚ ਤਾਂ ਕੁਛ ਪਿਆ ਵੀ ਨਹੀਂ ਅਤੇ ਧੱਕਾ ਹੀ ਆ ਵੈਸੇ ਫੋਰਨ ਬਾਹਰ ਤਾਂ ਧੱਕਾ ਹੀ ਆ ਸਾਰੇ ਹਾਂਜੀ ਹਾਂਜੀ ਇਹ ਤਾਂ ਹੈ ਬਟ ਫਿਰ ਵੀ ਇੱਧਰ ਰਹਿ ਕੇ ਵੀ ਕੋਈ ਕੰਮ ਕਰਨਾ ਚਾਹੀਦਾ ਜਿਨ੍ਹਾਂ ਨਾਲ ਰੁਜ਼ਗਾਰ ਤਾਂ ਬਹੁਤ ਜ਼ਿਆਦਾ ਪਰ ਲੋਕ ਸਮਝ ਨਹੀਂ ਰਹੇ ਉਸ ਰੁਜ਼ਗਾਰ ਨੂੰ ਬਾਹਰ ਹੀ ਭੱਜ ਰਹੇ ਹੈ ਜਿੰਨਾ ਹੋਵੇ ਬਾਹਰ ਜਾ ਜਾ ਕੇ ਕੰਮ ਕਰਨਾ ਚਾਹੁੰਦੇ ਆ ਜੋ ਕਿ ਇੱਧਰ ਰਹਿ ਕੇ ਵੀ ਕੰਮ ਕਰ ਸਕਦੇ ਹੈ ਹੂੰ ਹਾਂਜੀ ਮੈਂ ਇਸ 'ਤੇ ਵੀ ਬਣਾਉਣ ਵਲੋਗ ਬਣਾਉਂਦੀ ਸੀ ਹਾਂਜੀ ਹਾਂਜੀ ਠੀਕ ਹੂੰ ਠੀਕ ਹੈ